ਹਾਂ ਮੈਨੂੰ ਚਿੱਤਰਕਾਰੀ ਕਰਨਾ ਬਹੁਤ ਹੀ ਪਸੰਦ ਹੈ ਮੇਰਾ ਬਚਪਨ ਤੋਂ ਹੀ ਸਪਨਾ ਕਿ ਮੈਂ ਚਿੱਤਰਕਾਰੀ ਜੋ ਕਿ ਕਰਦੀ ਰਹਾਂ ਸਾਡੇ ਸਕੂਲ ਵਿੱਚ ਵੀ ਚਿੱਤਰਕਾਰੀ ਦੀਆਂ ਬਹੁਤ ਸਾਰੀਆਂ ਕਲਾਸਾਂ ਲੱਗਦੀਆਂ ਹਨ ਜੋ ਕਿ ਮੈਂ ਅਟੈਂਡ ਕਰਦੀ ਹਾਂ ਹਰ ਕਲਾਸ ਚਿੱਤਰਕਾਰੀ ਦੀ ਅਟੈਂਡ ਕਰਦੀ ਹਾਂ ਮੈਂ ਚਿੱਤਰਕਾਰ ਸਾਡੀ ਟੀਚਰ ਅਧਿਆਪਕ ਅਲੱਗ ਅਲੱਗ ਤਰ੍ਹਾਂ ਦੇ ਚਿੱਤਰ ਬਣਾਉਣਾ ਸਿਖਾਉਂਦੇ ਹਨ ਅਸੀਂ ਅਤੇ ਅਸੀਂ ਪੂਰੀ ਸ਼ਿੱਦਤ ਨਾਲ ਉਹ ਚਿੱਤਰਾਂ ਆ ਜੋ ਕਿ ਹੈ ਉਹ ਆਪਣੀ ਕੋਪੀ 'ਤੇ ਉਤਾਰਦੇ ਹਾਂ ਪੂਰੀ ਤਰ੍ਹਾਂ ਸ਼ਿੱਦਤ ਨਾਲ ਆਪਣੀ ਸ਼ਿੱਦਤ ਕਲਾ ਜਿਹੜੀ ਹੈ ਉਹ ਚਿੱਤਰਦੇ ਹਾਂ ਪੇਜ਼ 'ਤੇ ਅਤੇ ਪਰ ਹਾਂ ਮੈਂ ਵਰਕਸ਼ੋਪ ਲਈ ਕਦੇ ਵੀ ਨਹੀਂ ਗਈ ਪਰ ਮੇਰਾ ਇਹ ਸੁਪਨਾ ਹੈ ਕਿ ਮੈਂ ਵਰਕਸ਼ੋਪ ਲਈ ਜ਼ਰੂਰ ਜਾਵਾਂ